ਹੈਲੋ ਬਾਈ ਤੁਸੀਂ ਮਾਨਸਾ ਕਾਲਜ ਚੋਂ ਗੱਲ ਕਰਦੇ ਹੋ ਬਾਈ ਤੁਸੀਂ ਹੋਸਟਲ 'ਚ ਰਹਿੰਦੇ ਹੋ ਬਾਈ ਮੈ ਵੀ ਹੁਣ ਪਲੱਸ ਟੂ ਕਰ ਲਈ ਹੁਣ ਮੈਂ ਇੱਥੇ ਆਉਣਾ ਮਾਹੌਲ ਕਿੱਦਾਂ ਦਾ ਬਈ ਲੜਾਈ ਪੜ੍ਹਾਈ ਕਿਵੇਂ ਚੱਲ ਰਹੀ ਹੈ ਅਤੇ ਬਾਈ ਇੱਕ ਕਮਰੇ ਵਿੱਚ ਕਿੰਨੇ ਜਣੇ ਰਹਿੰਦੇ ਨੇ ਉਰੇ ਸਟਾਫ਼ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜੇ ਕੋਈ ਬਾਹਰੋਂ ਬੰਦਾ ਆਵੇ ਰਹਿਣ ਲਈ ਰੱਖ ਸਕਦੇ ਨੇ ਲੱਗਦੀ ਹੈ ਡੇਲੀ ਹਾਜ਼ਰੀ ਲੱਗਦੀ ਹੈ ਅਤੇ ਫੀਸ ਕੀ ਹੈ ਜੀ ਅਤੇ ਕੋਈ ਘਟਾ ਸਕਦੇ ਨੇ ਇੱਥੇ ਆ ਕੇ ਜੀ ਮੈਨੂੰ ਕੀਦੇ ਨਾਲ ਗੱਲ ਕਰਨੀ ਪਊ ਤੁਹਾਨੂੰ ਉਰੇ ਰਹਿੰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਅਤੇ ਤੁਹਾਡੇ ਨਾਲ ਕਿਸੇ ਨੇ ਲੜਾਈ ਲੜੂਈ ਤਾਂ ਨਹੀਂ ਕੀਤੀ ਇੱਥੇ ਪਾਣੀ ਪੂਣੀ ਦਾ ਵਧੀਆ ਪ੍ਰਬੰਧ ਆ ਆਸ ਪਾਸ ਘੁੰਮਣ ਨੂੰ ਕੋਈ ਕੁਛ ਕਹਿੰਦਾ ਤਾਂ ਨਹੀ ਇੱਥੇ ਖਾਣ ਪੀਣ ਲਈ ਕੰਟੀਨ ਹੈਗੀ ਜੀ ਹੋਰ ਦੱਸ ਦਿਓ ਜੀ ਇਹਨਾਂ ਬਾਰੇ ਚਲੋ ਜੀ ਫਿਰ ਮੈਂ ਕੱਲ੍ਹ ਨੂੰ ਆਊਂਗਾ ਜੀ ਠੀਕ ਜੀ ਧੰਨਵਾਦ